ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਰਜੇਸ ਪੁੱਤਰ ਵਧੀਆ ਜੀ ਤੁਸੀਂ ਸੁਣਾਓ ਘਰੇ ਸਭ ਚੰਗਾ ਵਧੀਆ ਜੀ ਤੁਸੀਂ ਮੇਰੀ ਗੱਲ ਸੁਣੋ ਪੁੱਤਰ ਸਾਡਾ ਤੁਹਾਨੂੰ ਪਤਾ ਹੀ ਆ ਕਾਲਜ ਆਪਣਾ ਨੈਸ਼ਨਲ ਲੈਵਲ ਪੀ ਟੀ ਓ ਦਾ ਟੂਰਨਾਮੈਂਟ ਕਰਾ ਰਿਹਾ ਕ੍ਰਿਕਟ ਜੀ ਅਤੇ ਮੈਂ ਚਾਹੁੰਦਾ ਬਈ ਤੁਸੀਂ ਸਾਡੇ ਕਾਲਜ ਨੂੰ ਉਸ ਵਿੱਚ ਰਿਪ੍ਰਜੈਂਟ ਕਰੋ ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਵਧੀਆ ਖੇਡਦੇ ਹੋ ਅਤੇ ਮੇਰੀ ਤੁਸੀਂ ਗੱਲ ਸੁਣੋ ਆਪਣਾ ਕੀ ਕਹਿੰਦੇ ਆ ਇਹ ਹੋਣਾ ਪੰਜ ਤੋਂ ਲੈ ਕੇ ਨੌਂ ਫਰਵਰੀ ਤੱਕ ਆਪਣੇ ਕਾਲਜ 'ਚ ਹੀ ਟ੍ਰੇਨਿੰਗ ਕੈਂਪ ਲੱਗਣਾ ਸਿਲੈਕਸ਼ਨ ਲਈ ਅਤੇ ਮੈਂ ਚਾਹੁੰਦਾ ਤੁਸੀਂ ਇਸ ਵਿੱਚ ਆਓ ਅਤੇ ਆਪਣਾ ਪੂਰਾ ਯੋਗਦਾਨ ਦੇਵੋ ਤੁਸੀਂ ਵਿਹਲੇ ਹੋ ਨਾ ਇਹਨਾਂ ਡੇਟਸ ਵਿੱਚ ਵਿਹਲੇ ਹੋ ਨਾ ਤੁਸੀਂ ਹਾਂਜੀ ਬਿਲਕੁਲ ਅਤੇ ਹੁਣ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਤੁਸੀਂ ਜਿਹੜੇ ਜਿਹੜੇ ਡਾਕੂਮੈਂਟ ਲੈ ਕੇ ਆਉਂਦੇ ਪਹਿਲਾਂ ਉਹ ਮੈਨੂੰ ਧਿਆਨ ਨਾਲ ਸੁਣ ਲਓ ਇੱਕ ਤਾਂ ਮੈਨੂੰ ਤੁਹਾਡੇ ਚਾਹੀਦੇ ਆ ਆਧਾਰ ਕਾਰਡ ਦੀ ਫੋਟੋ ਕਾਪੀ ਠੀਕ ਹੈ ਮੈਨੂੰ ਦੋ ਫੋਟੋ ਕਾਪੀਸ ਲੈ ਆਓ ਤੁਸੀਂ ਕਿਉਂਕਿ ਕਈ ਦਾ ਇਹਨਾਂ ਨੇ ਕਿ ਲੇਕਿਨ ਆਪਾਂ ਫਿਰ ਵੀ ਸੇਫਟੀ ਲਈ ਦੋ ਫੋਟੋ ਕੋਪੀਜ ਲੈ ਕੇ ਚਲੀਏ ਠੀਕ ਹੈ ਅਤੇ ਨਾਲ ਤੁਸੀਂ ਆਪਣੀ ਦੋ ਪਾਸਪੋਰਟ ਸਾਈਜ਼ ਫੋਟੋਜ਼ ਲੈ ਆਈਓ ਠੀਕ ਹੈ ਅਤੇ ਇੱਕ ਆਪਣੇ ਮਾਤਾ ਅਤੇ ਪਿਤਾ ਜੀ ਦੀ ਵੀ ਫੋਟੋ ਲੈ ਆਈਓ ਨਾਲ ਠੀਕ ਹੈ ਇਹ ਡਾਕੂਮੈਂਟ ਤੁਸੀਂ ਭੁੱਲਣੇ ਨਹੀਂ ਹੈ ਯਾਦ ਨਾਲ ਲੈ ਕੇ ਆਈਓ ਅਤੇ ਉਸ ਤੋਂ ਬਾਅਦ ਆਪਾਂ ਕੀ ਕਹਿੰਦੇ ਆ ਤੁਸੀਂ ਆਪਣੀ ਟ੍ਰੇਨਿੰਗ ਕਿੱਟ ਸਾਰਾ ਕੁਝ ਨਾਲ ਲੈ ਕੇ ਆਉਣਾ ਕਿਉਂਕਿ ਆਪਾਂ ਇਹਨਾਂ ਚਾਰ ਦਿਨ 'ਚ ਤੁਸੀਂ ਕਾਲਜ ਦੇ ਹੋਸਟਲ 'ਚ ਰੁਕੋਗੇ ਕਿਉਂਕਿ ਆਪਣਾ ਸ਼ਡਿਊਲ ਜਿਹੜਾ ਆਪਣੀ ਸਵੇਰੇ ਵੀ ਟਰੇਨਿੰਗ ਲੱਗੀ ਅਤੇ ਆਪਣੀ ਸ਼ਾਮੀ ਵੀ ਟਰੇਨਿੰਗ ਲੱਗਣੀ ਅਤੇ ਤੁਹਾਡੇ ਕਾਲਜ ਆ ਵੀ ਚੱਲਣੇ ਆ ਵਿੱਚ ਤਾਂ ਕਿ ਆਪਣੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਜ਼ਿਆਦਾ ਠੀਕ ਆ ਇਸ ਲਈ ਸਵੇਰੇ ਕਿਉਂਕਿ ਪੜ੍ਹਾਈ ਤੁਹਾਨੂੰ ਪਤਾ ਹੀ ਪੂਰੀ ਨਾਲ ਜ਼ਰੂਰੀ ਆ ਇਸ ਲਈ ਆਪਣੀ ਪੰਜ ਤੋਂ ਲੈ ਕੇ ਸਵੇਰੇ ਸੱਤ ਵਜੇ ਤੱਕ ਆਪਣੀ ਟ੍ਰੇਨਿੰਗ ਚਲੂਗੀ ਠੀਕ ਹੈ ਉਸ ਤੋਂ ਬਾਅਦ ਆਪਣੀ ਸ਼ਾਮੀ ਚੱਲੂਗੀ ਛੇ ਤੋਂ ਲੈ ਕੇ ਅੱਠ ਜਾਂ ਨੌਂ ਵਜੇ ਤੱਕ ਉਹ ਬਾਹਰੋਂ ਸਲੈਕਟਰ ਆਉਣਗੇ ਉਹ ਤੁਹਾਨੂੰ ਸਾਰਾ ਐਕਸਪਲੇਨ ਕਰ ਦੇਣਗੇ ਬਟ ਤੁਸੀਂ ਆ ਟਾਈਮ ਨਾਲ ਜਾਈਓ ਠੀਕ ਹੈ ਉਸ ਤੋਂ ਬਾਅਦ ਕੀ ਕਹਿੰਦੇ ਆ ਆਪਾਂ ਹੁਣ ਆਪਣੀ ਡਾਇਟ ਦਾ ਬਹੁਤ ਧਿਆਨ ਰੱਖਣਾ ਕਿਉਂਕਿ ਕ੍ਰਿਕਟ ਤੁਹਾਨੂੰ ਪਤਾ ਹੀ ਹੈ ਬਈ ਡਾਇਟ ਕਿੰਨੀ ਜ਼ਰੂਰੀ ਹੈ ਨਹੀਂ ਤਾਂ ਤੁਹਾਡੀ ਸਿਹਤ ਖ਼ਰਾਬ ਹੋ ਗਈ ਤਾਂ ਔਖਾ ਹੋਜੂਗਾ ਕੰਮ

ਚਲੋ ਮੈਂ ਚਲੋ ਬਾਈ ਦੇਖੋ ਜਿਹੜੀ ਜਿਹੜੀ ਮੇਨ ਮੇਨ ਡਾਇਟ ਆ ਉਹ ਤਾਂ ਆਪਣੀ ਕਾਲਜ ਵਿੱਚ ਤੁਹਾਨੂੰ ਮਿਲ ਹੀ ਜਾਣੀ ਆ ਠੀਕ ਆ ਹੁਣ ਤੁਸੀਂ ਫਿਰ ਅੱਜ ਤੋਂ ਹੀ ਆਪਣੀ ਡਾਇਟ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ ਤੁਸੀਂ ਕੀ ਕਰੋ ਸਵੇਰੇ ਉੱਠਦੇ ਪਹਿਲਾ ਤਾਂ ਦੋ ਗਲਾਸ ਗਰਮ ਪਾਣੀ ਦੇ ਪੀਓ ਠੀਕ ਹੈ ਨਾਸ਼ਤਾ ਤੁਸੀਂ ਰੱਖੋ ਆਪਣਾ ਫਲ ਫਰੂਟ ਖਾਓ ਨਾਲ ਪਿਓ ਦੁੱਧ ਦਾ ਗਿਲਾਸ ਠੀਕ ਆ ਦਿਨ ਵਿੱਚ ਤੁਸੀਂ ਦੁਪਹਿਰੇ ਜਾ ਕੇ ਦੁਪਹਿਰ ਕਰੀਬ ਆ ਜਾਂਦੇ ਉਦੋਂ ਤੁਸੀਂ ਖਾਓ ਆਪਣੀ ਸਬਜ਼ੀ ਨਾਲ ਰੋਟੀ ਖਾਓ ਜਿੰਨੀ ਤੁਸੀਂ ਰੂਟੀਨ 'ਚ ਖਾਂਦੇ ਹੋ ਪਰ ਸਬਜ਼ੀ ਹਲਕੀ ਖਾਓ ਬਾਹਰ ਦਾ ਖਾਣ ਤੋਂ ਬਿਲਕੁਲ ਤੁਸੀਂ ਛੱਡ ਦਿਓ ਹੁਣ ਕਿਉਂਕਿ ਆਪਾਂ ਸਿਲੈਕਸ਼ਨ ਕਰਾਉਣੀ ਆ ਆਪਣੇ ਬੱਚੇ ਦੀ ਇਧਰੋਂ ਹਾਂਜੀ ਹਾਂਜੀ ਦੇਖੋ ਪੰਜ ਤੋਂ ਨੌਂ ਤੋਂ ਲੈ ਪੰਜ ਤੋਂ ਨੌਂ ਤੋਂ ਤੁਸੀਂ ਪੂਰੀ ਕਾਲਜ ਜ਼ਿੰਮੇਵਾਰੀ ਹੋ ਮੇਰੀ ਅੰਡਰ ਰਹਿਣਾ ਤੁਸੀਂ ਮੇਰੇ ਬੱਚੇ ਆਪਣੇ ਬੱਚਿਆਂ ਵਰਗੇ ਹੋ ਤੁਸੀਂ ਮੈਂ ਹੀ ਦੇਖਣਾ ਤੁਹਾਨੂੰ ਠੀਕ ਹੈ ਉਹ ਸਾਰਾ ਕੁਝ ਕਾਲਜ 'ਚ ਹੋਵੇਗਾ ਪਰ ਮੈਂ ਕਹਿ ਰਿਹਾ ਆਪਾਂ ਪਹਿਲਾਂ ਤੋਂ ਹੀ ਕਰ ਦੇ ਤੁਸੀਂ ਅੱਜ ਤੋਂ ਆਪਣੀ ਡਾਇਟ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ ਤਾਂ ਕਿ ਆਪਾਂ ਪੂਰੇ ਫਿਟ ਰਹੀਏ ਠੀਕ ਹੈ ਨਾ ਹਾਂ ਇਸ ਲਈ ਉਹੀ ਕਹਿ ਰਿਹਾ ਮੈਂ ਤੁਸੀਂ ਦੁਪਹਿਰੇ ਬਾਹਰ ਦਾ ਖਾਣਾ ਤਾਂ ਆਪਾਂ ਦੇਖੋ ਬਿਲਕੁਲ ਛੱਡ ਦਿੰਦਾ ਫ਼ਿਲਹਾਲ ਕਿਉਂਕਿ ਆਪਾਂ ਸਲੈਕਸ਼ਨ ਕਰਾਉਣੀ ਆ ਆਪਣੀ ਆਪਾਂ ਛੱਡ ਦੀ ਨਹੀਂ ਹੈ ਬਹੁਤ ਵੱਡੀ ਓਪੋਰਚਨਿਟੀ ਹੁੰਦੀ ਆ

ਆਪਾਂ ਦੇਖੋ ਪੰਜ ਨੂੰ ਆਪਣਾ ਸਿਲੈਕਸ਼ਨ ਸ਼ੁਰੂ ਹੈ ਤੁਸੀਂ ਕਾਲਜ ਆਉਣਾ ਲੈਣਾ ਫਰਵਰੀ ਨੂੰ ਤੁਹਾਡਾ ਕਾਲਜ ਲੱਗਣਾ ਠੀਕ ਹੈ ਤੁਸੀਂ ਤੁਸੀਂ ਤਿੰਨ ਨੂੰ ਹੀ ਆਪਣੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲ ਆ ਜਾਓ ਆਪਾਂ ਰਜਿਸਟਰੇਸ਼ਨ ਉਥੇ ਹੀ ਕਰ ਦੇਵਾਂਗੇ ਕਰ ਦੇਣੀ ਤੁਹਾਡੀ ਇਕੱਠੇ ਬਹਿ ਕੇ ਠੀਕ ਹੈ ਉਹ ਆਪਾਂ ਡਿਲੇ ਕਰਨਾ ਹੀ ਨਹੀਂ ਮੈਂ ਤੁਹਾਨੂੰ ਡਾਇਟ ਸਮਝਾ ਦਿੰਦਾਂ ਦੁਬਾਰਾ ਇੱਕ ਵਾਰ ਸਵੇਰੇ ਉੱਠ ਕੇ ਤੁਸੀਂ ਦੋ ਗਿਲਾਸ ਪਾਣੀ ਦੇ ਪੀਣੇ ਆ ਠੀਕ ਆ ਨਾਸ਼ਤਾ ਤੁਸੀਂ ਚਲੋ ਠੀਕ ਆ ਫਿਰ ਮੈਨੂੰ ਡਾਇਟ ਆ ਗਈ ਸਮਝ ਚਲੋ ਠੀਕ ਆ ਤੁਸੀਂ ਮੈਨੂੰ ਉਸ ਦਿਨ ਆਓਗੇ ਨਾ ਆਪਾਂ ਉਸ ਦਿਨ ਗੱਲ ਕਰ ਲਾਂਗੇ ਸਾਰੀ ਚਲੋ ਮੈਂ ਰੱਖਦਾ ਫਿਰ ਫਓਨ ਓਕੇ ਜੀ ਬਾਏ ਜੀ ਬਾਏ ਓਕੇ ਜੀ ਧਿਆਨ ਰੱਖੋ